ਮੇਰਾ ਮਨ ਪਸੰਦੀ ਪਕਵਾਨ ਜੋ ਹਰ ਵੇਲੇ ਵਧੀਆ ਲੱਗਦਾ ਹੈ ਅਤੇ ਖਾਣ 'ਚ ਵੀ ਵਧੀਆ ਹੈ ਅਤੇ ਬਣਾਉਣ 'ਚ ਵੀ ਈਜ਼ੀਲੀ ਬਣ ਜਾਂਦਾ ਹੈ ਉਹ ਹੈ ਮਟਰਾਂ ਵਾਲੇ ਚਾਵਲ ਜਿਸ ਨੂੰ ਬਣਾਉਣ ਲਈ ਸਾਨੂੰ ਚਾਵਲ ਚਾਹੀਦੇ ਹਨ ਮਟਰ ਚਾਹੀਦੇ ਹਨ ਸਬਜ਼ੀਆਂ ਵੀ ਅਸੀਂ ਪਾ ਸਕਦੇ ਹਾਂ ਗਾਜਰਾਂ ਹੋ ਗਈਆਂ ਗੋਭੀ ਹੋ ਗਈ ਆਲੂ ਹੋ ਗਏ ਮਟਰ ਹੋ ਗਏ ਪਿਆਜ਼ ਟਮਾਟਰ ਲਸਣ ਅਸੀਂ ਪਾ ਕੇ ਸਾਰਾ ਕੁਛ ਅਤੇ ਇਹਨੂੰ ਬਣਾ ਸਕਦੇ ਹਾਂ ਇਸ ਨੂੰ ਬਣਾਉਣ ਦੇ ਲਈ ਸਾਨੂੰ ਪਹਿਲਾਂ ਕੁੱਕਰ ਚਾਹੀਦਾ ਹੈ ਕੁੱਕਰ ਦੇ ਵਿੱਚ ਸਾਨੂੰ ਤੇਲ ਪਾ ਕੇ ਜੀਰਾ ਪਾਵਾਂਗੇ ਉਸ ਤੋਂ ਬਾਅਦ ਜੀਰਾ ਪਾਉਣ ਤੋਂ ਬਾਅਦ ਚਾਵਲਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਅਤੇ ਸਬਜ਼ੀਆਂ ਜਿਹੜੀਆਂ ਤੁਸੀਂ ਵਿੱਚ ਐਡ ਕਰਨੀਆਂ ਹਨ ਗਾਜਰ ਹੋਈ ਗੋਭੀ ਹੋਈ ਮਟਰ ਹੋਏ ਆਲੂ ਹੋਏ ਉਹਨਾਂ ਨੂੰ ਅੱਛੀ ਤਰ੍ਹਾਂ ਕੱਟ ਕੇ ਧੋ ਲੈਣਾ ਹੈ ਧੋਣ ਤੋਂ ਬਾਅਦ ਉਸ ਨੂੰ ਤੜਕੇ ਦੇ ਵਿੱਚ ਸੁੱਟਣਾ ਹੈ ਸਾਰੇ ਮਸਾਲੇ ਨੂੰ ਸੁੱਟ ਕੇ ਉਸ ਤੋਂ ਬਾਅਦ ਨਮਕ ਮਿਰਚ ਆਪਣੀ ਲੋੜ ਅਨੁਸਾਰ ਪਾਉਣ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਹਿਲਾ ਕੇ ਥੋੜ੍ਹੀ ਦੇਰ ਪੱਕਣ ਦੇਣਾ ਹੈ ਪੱਕਣ ਤੋਂ ਬਾਅਦ ਜੋ ਚਾਵਲ ਅਸੀਂ ਧੋ ਕੇ ਰੱਖੇ ਹਨ ਉਸ ਨੂੰ ਕੁੱਕਰ ਵਿੱਚ ਸਿੱਟ ਦੇਣਾ ਹੈ ਸਿੱਟਣ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਹਿਲਾ ਕੇ ਉਸਦੇ ਅਨੁਸਾਰ ਜਿੰਨੇ ਚਾਵਲ ਹਨ ਡਬਲ ਪਾਣੀ ਪਾ ਕੇ ਉਸਨੂੰ ਕੁੱਕਰ ਦਾ ਢੱਕਣ ਬੰਦ ਕਰ ਦੇਣਾ ਹੈ ਉਸ ਤੋਂ ਬਾਅਦ ਉਪਰੋਂ ਦੀ ਸੀਟੀ ਲਗਵਾ ਦੇਣੀ ਚਾਹੀਦੀ ਹੈ ਇੱਕ ਸੀਟੀ ਆਉਣ ਤੋਂ ਬਾਅਦ ਤੁਹਾਡੇ ਚਾਵਲ ਤਿਆਰ ਹਨ ਗਰਮਾ ਗਰਮ ਮਟਰਾਂ ਵਾਲੇ ਚਾਵਲ ਅਸੀਂ ਸਰਵ ਕਰਕੇ ਖਾ ਸਕਦੇ ਹਾਂ